ਹਾਂਜੀ ਹਾਂਜੀ ਬੋਲੋ ਜੀ ਬੋਲੋ ਕੀ ਕਰਵਾਉਣਾ ਜੀ ਜੀ ਲਾਈਟਾਂ ਆਪਣੇ ਕੋਲ ਸਾਰੀਆਂ ਲਾਈਟਾਂ ਅਵੇਲੇਬਲ ਹੈ ਅੱਛਾ ਜੀ ਤੁਸੀਂ ਲਾਈਟਾਂ ਕਿਹੜੀਆਂ ਲਵਾਉਣੀਆਂ ਪਹਿਲਾਂ ਐਂ ਦੱਸੋ ਜੀ ਅੱਛਾ ਕਲਰ ਕੋਂਬੀਨੇਸ਼ਨ ਅੱਛਾ ਅਤੇ ਕਿੰਨੀਆਂ ਕਿ ਅਤੇ ਕਿੰਨਾ ਕਿੰਨੀਆਂ ਕੁ ਹੈਗੀਆਂ ਆਪਦੇ ਹਿਸਾਬ ਨਾਲ ਹਾਂ ਕੋਈ ਨਹੀਂ ਉਹ ਤਾਂ ਭੇਜਦਾਂਗੇ ਹਾਂ ਸਰ ਸਕੇਰ ਫੁੱਟ ਤਾਂ ਨਹੀਂ ਉਹ ਤਾਂ ਤੁਹਾਡਾ ਅਸੀਂ ਮੰਗਾ ਲਵਾਂਗੇ ਅਸੀਂ ਲਾਈਟਾਂ ਹਿਸਾਬ ਨਾਲ ਮੰਗਾਉਂਦੇ ਹਾਂ ਵੀ ਜਿੰਨੀਆਂ ਵੀ ਜਿੰਨੀਆਂ ਵੀ ਅਸੀਂ ਵੇਖ ਲਵਾਂਗੇ ਵੀ ਉਹ ਤਾਂ ਤੁਹਾਡੇ 'ਤੇ ਡਿਪੈਂਡ ਹੈ ਨਾ ਤੁਸੀਂ ਤੁਸੀਂ ਦੂਰ ਦੂਰ ਲਵਾਉਣਾ ਚਾਹੁੰਦੇ ਹੋ ਨੇੜੇ ਨੇੜੇ ਲਵਾਉਣਾ ਚਾਹੁੰਦੇ ਹੋ ਜਿਵੇਂ ਵੀ ਉਹ ਤਾਂ ਤੁਹਾਡੇ 'ਤੇ ਡਿਪੈਂਡ ਆ ਰੇਟ ਤਾਂ ਰੇਟ ਤਾਂ ਰੇਟ ਤਾਂ ਸਰ ਜਾਇਜ਼ ਹੀ ਆ ਦੇਖੋ ਸਭ ਤੋਂ ਚੰਗੀਆਂ ਲਾਈਟਾਂ ਲਵਾਉਣੀਆਂ ਸਭ ਤੋਂ ਚੰਗਾ ਕੰਮ ਕਰਾਉਣਾ ਫਿਰ ਰੇਟ ਦਾ ਤਾਂ ਕੋਈ ਇਸ਼ੂ ਹੋਣਾ ਹੀ ਨਹੀਂ ਚਾਹੀਦਾ ਨਾ ਨਾਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਉਹ ਨਾਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਨਾਂ ਤਾਂ ਤੁਹਾਨੂੰ ਪਤਾ ਨਾਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਆਪਣਾ ਠੀਕ ਹੈ ਕਿਉਂਕਿ ਆਪਾਂ ਕੰਮ ਹੀ ਇਹੋ ਜਿਹੇ ਕਰ ਰੱਖਿਆ ਪੂਰੇ ਸ਼ਹਿਰ ਦੇ ਵਿੱਚ ਅਤੇ ਕੋਈ ਨਹੀਂ ਤੁਸੀਂ ਦੱਸੋ ਲਾਈਟਾਂ ਆਪਾਂ ਮੁੰਡਾ ਭੇਜ ਦਿੰਦੰ ਹਾਂ ਅਤੇ ਜਿਵੇਂ ਵੀ ਸਕੇਅਰ ਫੁੱਟ ਦੇ ਹਿਸਾਬ ਨਾਲ ਮੁੰਡਾ ਆਪੇ ਟਰੇਨਡ ਹੈਗਾ ਸਾਡਾ ਮੁੰਡਾ ਪੂਰਾ ਜਿਵੇਂ ਵੀ ਉਹ ਕਹਿੰਦਾ ਸਕੇਅਰ ਫੁੱਟ ਦੇ ਹਿਸਾਬ ਨਾਲ ਮੁਕਾਏਗਾ ਜਿਵੇਂ ਦੀ ਉਹ ਕਹਿੰਦਾ ਉਸ ਹਿਸਾਬ ਨਾਲ ਆਪਾਂ ਮੁਕਾ ਲੈਂਦੇ ਹਾਂ ਕੋਈ ਇਸ਼ੂ ਹੀ ਨਹੀਂ ਹੈਗਾ ਅਤੇ ਤੁਸੀਂ ਆ ਤੁਹਾਨੂੰ ਅਸੀਂ ਕੱਲ੍ਹ ਭੇਜ ਦਈਏ ਜਾਂ ਅੱਜ ਉਹ ਸਰ ਆ ਹੀ ਤਾਂ ਗੱਲ ਹੈ ਨਾ ਓਹ ਆਹੀ ਆਹੀ ਤਾਂ ਗੱਲ ਤੁਹਾਨੂੰ ਪਤਾ ਤਿਉਹਾਰਾਂ ਦਾ ਸੀਜ਼ਨ ਹੈ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਕੰਮ ਹੀ ਬੜਾ ਹੋਇਆ ਪਿਆ ਅਤੇ ਕੋਈ ਨਾ ਅਸੀਂ ਜਿੰਨਾਂ ਜਲਦੀ ਹੋ ਸਕੇ ਭੇਜਾਂਗੇ ਅਤੇ ਤੁਸੀਂ ਦੱਸ ਦਿਓ ਮੁੰਡੇ ਨੂੰ ਸਾਰਾ ਕਿ ਆਹ ਲਾਈਟਾਂ ਐਵੇਂ ਕਿਹੜਾ ਕਲਰ ਹੈ ਕੋਈ ਵੀ ਆਪਾਂ ਨਹੀਂ ਕਿਵੇਂ ਤਾਰਾਂ ਆਪਣੇ ਨਹੀਂ ਫਿਟਿੰਗ ਨਹੀਂ ਹੋਈ ਹੋਈ ਘਰ ਦੇ ਵਿੱਚ ਅੱਛਾ ਫਿਟਿੰਗ ਵੀ ਕਰਾਉਣੀ ਆ ਅੱਛਾ ਕੋਈ ਨਹੀਂ ਫੀਟਿੰਗ ਕਰਾਉਣੀ ਆ ਜੋ ਵੀ ਆਪਣੇ ਕੋਲ ਹਰ ਚੀਜ਼ ਅਵੇਲੇਬਲ ਹੈ ਤੁਸੀਂ ਫਿਟਿੰਗ ਕਰਵਾਓ ਚਾਹੇ ਲਾਈਟਾਂ ਲਵਾਓ ਚਾਹੇ ਜੋ ਕੁਛ ਵੀ ਕਰਵਾਓ ਉਹ ਤੁਹਾਡਾ ਰੇਟ ਆਪਾਂ ਆਪਦੇ ਹਿਸਾਬ ਨਾਲ ਲਾ ਲੇ ਕੋਈ ਨਹੀਂ ਸਰ ਜਾਇਜ਼ ਜਾਇਜ਼ ਹੀ ਲਾਵਾਂਗੇ ਕੋਈ ਗੱਲ ਨਹੀਂ ਤੁਹਾਡੇ ਕੋਲ ਕੱਲ੍ਹ ਸਾਡਾ ਮੁੰਡਾ ਪਹੁੰਚ ਜਾਏਗਾ ਕੋਈ ਨਹੀਂ ਜੀ ਕੱਲ੍ਹ ਮੈਂ ਆਪ ਹੀ ਆ ਜਾਊਗਾ ਜੇ ਟੈਂਸ਼ਨ ਨਾ ਲਉ ਉਹ ਕੱਲ੍ਹ ਆਪ ਹੀ ਆਜੂਗਾ ਮੈਂ ਟੈਂਸ਼ਨ ਨਾ ਲਉ ਜੀ ਠੀਕ ਹੈ ਜੀ ਠੀਕ ਹੈ ਜੀ